ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਛੱਬੀ ਜਨਵਰੀ ਉੱਨੀ ਸੌ ਪੰਜਾਹ ਸੱਤ ਸਤੰਬਰ ਅਠਾਰਾਂ ਸੌ ਪਚਾਸੀ ਪੱਚੀ ਸਤੰਬਰ ਅਠਾਰਾਂ ਸੌ ਤੀਹ ਤਿੰਨ ਜਨਵਰੀ ਉੱਨੀ ਸੌ ਛਿਹੱਤਰ